ਖੇਤੀਬਾੜੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ ਜਿਵੇਂ ਕਿ ਸਾਡੇ ਪੁਰਾਣੇ ਸਮੇਂ ਦੇ ਬਜ਼ੁਰਗ ਦੱਸਦੇ ਹਨ ਕਿ ਸਾਨੂੰ ਖੇਤੀ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਸੀ ਬਲਦਾਂ ਨਾਲ ਕਿਉਂਕਿ ਉਸ ਟਾਈਮ ਟ੍ਰੈਕਟਰ ਟਰਾਲੀਆਂ ਕਰਪਾਇਨਾਂ ਨਹੀਂ ਹੁੰਦੀਆਂ ਸਨ ਅੱਜ ਕੱਲ੍ਹ ਅੱਜ ਟ੍ਰੈਕਟਰ ਟਰਾਲੀਆਂ ਆ ਗਈਆਂ ਹਨ ਜਿਹਨਾਂ ਨਾਲ ਖੇਤੀ ਕਰਨੀ ਬਹੁਤ ਆਸਾਨ ਹੋ ਗਈ ਹੈ ਜਿਨ੍ਹਾਂ ਨਾਲ ਇੱਕ ਹਫ਼ਤੇ ਦਾ ਕੰਮ ਦੋ ਦਿਨਾਂ ਵਿੱਚ ਹੀ ਹੋ ਜਾਂਦਾ ਹੈ